ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਐਂ ਤੁਹਾਡੇ ਗੁਆਂਢ 'ਚ ਆਈ ਹਾਂ ਨਵੀਂ ਇੱਥੇ ਅਸੀਂ ਸ਼ਿਫਟ ਹੋਏ ਹਾਂ ਅਤੇ ਮੈਨੂੰ ਥੋੜ੍ਹੀ ਜਿਹੀ ਤੁਹਾਡੀ ਮਦਦ ਦੀ ਲੋੜ ਹੈ ਹਾਂਜੀ ਮੈਮ ਅਸੀਂ ਨਾ ਕੋਈ ਬਹੁਤ ਵੱਡੇ ਸ਼ਹਿਰ 'ਚੋਂ ਨਹੀਂ ਆਏ ਅਤੇ ਅਸੀਂ ਇੱਥੇ ਤੁਹਾਡੇ ਸ਼ਹਿਰ 'ਚ ਨਵੇਂ ਆਏ ਹਾਂ ਅਤੇ ਸਾਨੂੰ ਮੈਨੂੰ ਦੱਸੋ ਜ਼ਰਾ ਤੁਹਾਡੇ ਇੱਥੇ ਹੋਰ ਇੱਥੇ ਕਿਹੜੇ ਵੱਡੇ ਵੱਡੇ ਸ਼ਹਿਰ ਹੈ ਅਤੇ ਹੋਰ ਕੁਛ ਦੱਸੋ ਕਿਉਂਕਿ ਅਸੀਂ ਕੋਈ ਬਹੁਤਾ ਬਾਹਰ ਨਹੀਂ ਨਿਕਲੇ ਅਤੇ ਸਾਨੂੰ ਮੈਨੂੰ ਥੋੜ੍ਹਾ ਮਦਦ ਚਾਹੀਦੀ ਮੈਨੂੰ ਥੋੜ੍ਹਾ ਦੱਸੋ ਇਸ ਤੋਂ ਬਾਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਹਾਂ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਮ